ਹੈਲੋ ਹਾਂਜੀ ਪ੍ਰੀਇੰਦਰ ਭੈਣ ਜੀ ਕਿਵੇਂ ਓਂ ਠੀਕ ਹੈ ਉਹ ਜਿਹੜੇ ਪੀਏਯੂ ਵਾਲੇ ਆਏ ਸੀ ਗਲੋਬਲ ਵਾਰਮਿੰਗ ਬਾਰੇ ਦੱਸ ਰਹੇ ਸੀਗੇ ਮੈਥੋਂ ਨਾ ਆਇਆ ਨਹੀਂ ਗਿਆ ਉੱਥੇ ਅਤੇ ਤੁਸੀਂ ਮੈਨੂੰ ਉਹਦੇ ਬਾਰੇ ਦੱਸ ਦੋ ਮੈਂ ਸੁਣਿਆ ਵੀ ਕਾਫੀ ਵਧੀਆ ਦੱਸ ਕੇ ਗਏ ਨੇ ਆਪਣੀਆਂ ਫਸਲਾਂ ਬਾਰੇ ਹੋ ਰਹੇ ਨੁਕਸਾਨ ਬਾਰੇ ਅੱਛਾ ਅੱਛਾ ਅੱਛਾ ਹਾਂਜੀ ਚਲੋ ਆਪਾਂ ਨੂੰ ਪਾਣੀ ਦੀ ਲੋੜ ਹੁੰਦੀ ਆ ਉਦੋਂ ਸੋਕਾ ਪੈ ਜਾਂਦਾ ਹੈਂ ਅਤੇ ਗੜੇਮਾਰੀ ਹੋ ਜਾਂਦੀ ਹੈ ਬ ਫਸਲਾਂ 'ਤੇ ਖੜੀਆਂ ਅਤੇ ਢਹਿ ਜਾਂਦੀਆਂ ਨੇ ਇਹ ਮਤਲਬ ਇਹਦੇ ਬਾਰੇ ਹੀ ਉਹ ਦੱਸਦੇ ਸੀ ਹੈਂ ਆਪਾਂ ਨੂੰ ਹਮ ਹਾਂ ਹਾਂਜੀ ਹਾਂਜੀ ਇਹ ਤਾਂ ਗੱਲ ਬਿਲਕੁਲ ਸਹੀ ਆ ਮੈਂ ਵੀ ਸੁਣਿਆ ਸੀਗਾ ਕਿ ਵੀ ਕਹਿੰਦੇ ਵੀ ਇਸ ਬਾਰੇ ਦੱਸ ਕੇ ਗਏ ਨੇ ਤਾਂ ਹੀ ਮੈਂ ਸੋਚਿਆ ਨੂੰ ਪੁੱਛਾਂ ਗਲੋਬਲ ਵਾਰਮਿੰਗ ਬਾਰੇ ਕੀ ਦੱਸ ਕੇ ਗਏ ਨੇ ਚਲੋ ਚੰਗਾ ਕੀਤਾ ਤੁਸੀਂ ਹਾਂਜੀ ਚਲੋ ਚੰਗਾ ਕੀਤਾ ਤੁਸੀਂ ਮੈਨੂੰ ਦੱਸਤਾ ਹੁਣ ਆਪਾਂ ਅੱਗੇ ਤੋਂ ਧਿਆਨ ਰੱਖਾਂਗੇ ਠੀਕ ਠੀਕ ਹੈ ਭੈਣ ਜੀ